ਪੰਜਾਬ ਵਿੱਚ ਸਰਕਾਰ ਕਾਰੋਬਾਰਾਂ ਅਤੇ ਆਰਥਿਕ ਵਿਕਾਸ ਦਾ ਸਮਰਥਨ ਵੱਖ ਵੱਖ ਯੋਜਨਾਵਾਂ ਰਾਹੀਂ ਕਰ ਰਹੀ ਹੈ ਪਹਿਲਾਂ ਐਮ ਐਸ ਐਮ ਈ ਰਿਵਾਈਵਲ ਇੰਟਰਸਟ ਬੈਨੀਫਿਟਸ ਸਕੀਮ ਦੇ ਤਹਿਤ ਛੋਟੇ ਅਤੇ ਮੱਧਮ ਉਦਯੋਗਾਂ ਨੂੰ ਵਾਧੂ ਵਿੱਤੀ ਮਦਦ ਅਤੇ ਘੱਟ ਵਿਆਜ ਦਰਾਂ 'ਤੇ ਕਰਜ਼ੇ ਦਿੱਤੇ ਜਾਂਦੇ ਹਨ ਤਾਂ ਜੋ ਉਹ ਆਪਣੇ ਕਾਰੋਬਾਰ ਮੁੜ ਚਾਲੂ ਕਰ ਸਕਣ ਇਹ ਯੋਜਨਾ ਵਿਸ਼ੇਸ਼ ਤੌਰ 'ਤੇ ਕੋਵਿਡ ਨਾਈਨਟੀਨ ਤੋਂ ਪ੍ਰਭਾਵਿਤ ਉਦਯੋਗਾਂ ਲਈ ਫਾਇਦੇਮੰਦ ਰਹੀ ਹੈਗੀ ਆ ਦੂਜੇ ਨੰਬਰ 'ਤੇ ਨਵੇਂ ਸਟਾਰਟਅਪ ਨੂੰ ਹੋ ਗਏ ਅਤੇ ਉਦਯੋਗਕਾਰੀ ਯੋਜਨਾਵਾਂ ਨੂੰ ਪ੍ਰੇਰਿਤ ਕਰਨ ਲਈ ਸਰਕਾਰ ਵਿੱਤੀ ਮਦਦ ਕਰਦੀ ਹੈ ਇਨਕੁਏਸ਼ਨ ਸੈਂਟਰ ਖੋਲ੍ਹ ਰਹੀ ਹੈ ਅਤੇ ਸਬਸਿਡੀ ਦੀ ਪੇਸ਼ਕਸ਼ ਕਰ ਰਹੀ ਹੈ ਇਹ ਯੋਜਨਾਵਾਂ ਨਵੇਂ ਟੈਕਨੀਕ ਅਤੇ ਨਵੀਨਤਾ ਵਾਲੇ ਬਿਜਨਸ ਨੂੰ ਹੋਰ ਮਜ਼ਬੂਤ ਕਰਦੀਆਂ ਹਨ ਇਸ ਤੋਂ ਇਲਾਵਾ ਸਸਟੇਨੈਂਸ ਅਲਾਇੰਸ ਵਰਗੀਆਂ ਯੋਜਨਾਵਾਂ ਰਾਹੀਂ ਨਵੇਂ ਉਦਯੋਗਕਾਰੀ ਅਤੇ ਖੁਦਰੋ ਕਾਰੋਬਾਰ ਚਲਾਉਣ ਵਾਲਿਆਂ ਨੂੰ ਸ਼ੁਰੂਆਤੀ ਸਮੇਂ ਲਈ ਆਰਥਿਕ ਮਦਦ ਦਿੱਤੀ ਜਾਂਦੀ ਹੈ ਤਾਂ ਜੋ ਉਹ ਆਪਣੀ ਆਮਦਨ ਨੂੰ ਸਥਿਰ ਕਰ ਸਕਣ ਇਹਨਾਂ ਦੇ ਨਾਲ ਇੰਫਰਾਸਟਰਕਚਰ ਡਿਵਲਪਮੈਂਟ ਸਕਿਲ ਡਿਵਲਪਮੈਂਟ ਪ੍ਰੋਗਰਾਮਸ ਅਤੇ ਈਜ ਆਫ ਡੂਇੰਗ ਬਿਜਨਸ ਨੀਤੀਆ ਰਾਹੀਂ ਸਰਕਾਰ ਨਵੇਂ ਕਾਰੋਬਾਰ ਸ਼ੁਰੂ ਕਰਨ ਦੀ ਪ੍ਰਕਰਿਆ ਨੂੰ ਹੋਰ ਆਸਾਨ ਅਤੇ ਆਕਰਸ਼ਨ ਬਣਾ ਰਹੀ ਹੈ ਇਹ ਸਭ ਉਪਰਾਲੇ ਪੰਜਾਬ ਦੀ ਆਰਥਿਕਤਾ ਨੂੰ ਮਜਬੂਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ